ਸਤਿ ਸ਼੍ਰੀ ਅਕਾਲ ਮੈਂ ਤੁਹਾਨੂੰ ਚਾਰ ਨੰਬਰ ਦੱਸਦੀ ਹਾਂ ਇਕ ਸੌ ਬਾਰਾਂ ਦੋ ਸੌ ਉੱਨੀ ਪੰਜ ਸੌ ਸੱਠ ਸੱਤ ਸੌ ਬਾਰਾਂ ਇੱਕ ਹਜ਼ਾਰ ਚਾਰ ਧੰਨਵਾਦ